ਹੈਲੋ ਹਾਂਜੀ ਮੈਮ ਗੁੱਡ ਵੈਰੀ ਗੁੱਡ ਈਵਨਿੰਗ ਜੀ ਹਾਂਜੀ ਮੈਡਮ ਅੱਛਾ ਜੀ ਠੀਕ ਹੈ ਜੀ ਠੀਕ ਹੈ ਮੈਡਮ ਤੁਸੀਂ ਕਦੋਂ ਖਰੀਦੀ ਸੀ ਇਹ ਬੁੱਕ ਅੱਛਾ ਜੀ ਤੁਸੀਂ ਔਨਲਾਈਨ ਮੰਗਵਾਈ ਸੀ ਜਾਂ ਆਪ ਲੈ ਕੇ ਗਏ ਸੀ ਮੈਡਮ ਅੱਛਾ ਜੀ ਤੁਸੀਂ ਉਸ ਟੈਮ ਚੈੱਕ ਨਹੀਂ ਕੀਤਾ ਘਰ ਜਾ ਕੇ ਚੈੱਕ ਕੀਤਾ ਫਿਰ ਬੁੱਕ ਨੂੰ ਠੀਕ ਹੈ ਜੀ ਹੁਣ ਤੁਸੀਂ ਠੀਕ ਹੈ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਜਾਂ ਕੀ ਹਿਸਾਬ ਕਿਤਾਬ ਦੱਸ ਸਕਦੇ ਹੋ ਓਕੇ ਮੈਡਮ ਜਦੋਂ ਤੁਸੀਂ ਚਾਹੁੰਦੇ ਹੋ ਜਦੋਂ ਮਰਜ਼ੀ ਚੇਂਜ ਕਰ ਸਕਦੇ ਹੋ ਜੇ ਤੁਸੀਂ ਔਨਲਾਈਨ ਭੇਜਣਾ ਤਾਂ ਔਨਲਾਈਨ ਭੇਜ ਸਕਦੇ ਹੋ ਜੇ ਤੁਸੀਂ ਆਪ ਆਉਣਾ ਚਾਹੁੰਦੇ ਤੁਸੀਂ ਆਪ ਵੀ ਆ ਕੇ ਦੇ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਕਰਨਾ ਚਾਹੁੰਦੇ ਹੋ ਦੱਸ ਦਿਓ ਓਕੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਮੇਰੀ ਬੁੱਕ ਦਾ ਜੋ ਵੀ ਹਿਸਾਬ ਕਿਤਾਬ ਈਸ਼ੂ ਲਿਖ ਕੇ ਤੁਸੀਂ ਜੋ ਵੀ ਹੈ ਤੁਹਾਨੂੰ ਮੇਰਾ ਅਡਰੈੱਸ ਤਾਂ ਪਤਾ ਹੀ ਹੈ ਤੁਸੀਂ ਲੈ ਕੇ ਗਏ ਸੀ ਠੀਕ ਹੈ ਨਾ ਚੰਡੀਗੜ੍ਹ ਤੋਂ ਤੁਸੀਂ ਸਾਰਾ ਅਡਰੈੱਸ ਲਿਖ ਕੇ ਸਾਰਾ ਲਿਖ ਕੇ ਤੁਸੀਂ ਇੱਕ ਪਾਰਸਲ ਕਰ ਦਿਓ ਜੋ ਵੀ ਤੁਹਾਡੇ ਪਾਰਸਲ ਕਰਨ ਦੇ ਪੈਸੇ ਵੀ ਹੋਉਂਗੇ ਅਸੀਂ ਦੇਵਾਂਗੇ ਤੁਹਾਨੂੰ ਠੀਕ ਹੈ ਜਿਸ ਦਿਨ ਇਹ ਮੈਨੂੰ ਮਿਲ ਜਾਂਦੀ ਹੈ ਮੈਂ ਤੁਹਾਨੂੰ ਪੈਸੇ ਰੀਫੰਡ ਕਰ ਦੂੰਗਾ ਜੇ ਤੁਸੀਂ ਚਾਹੁੰਦੇ ਹੋ ਮੈਂ ਤੁਹਾਨੂੰ ਉਸ ਦੀ ਜਗ੍ਹਾ ਨਵੀਂ ਬੁੱਕ ਵੀ ਭੇਜ ਦੂੰਗਾ ਜੇ ਉਹ ਹੀ ਬੁੱਕ ਚਾਹੀਦੀ ਮੈਂ ਉਹ ਵੀ ਭੇਜ ਦੂੰਗਾ ਤੁਹਾਨੂੰ ਬਾਕੀ ਤੁਸੀਂ ਦੱਸ ਦਿਓ ਬਾਕੀ ਹੋਰ ਵੀ ਤੁਹਾਡੇ ਹਾਂਜੀ ਹੋਰ ਵੀ ਬਹੁਤ ਆਈਆਂ ਹੋਈਆਂ ਹੈ ਹਾਂ ਸਾਡੇ ਕੋਲ ਪੰਜਾਬੀ ਸਾਹਿਤ ਦੇ ਨਾਲ ਰਿਲੇਟਿਡ ਪੰਜਾਬੀ ਬੋਲੀ ਦੇ ਨਾਲ ਮਿਲਦੀਆਂ ਜੁਲਦੀਆਂ ਸੱਭਿਆਚਾਰਕ ਨਾਲ ਮਿਲਦੀਆਂ ਬਹ ਹਰ ਤਰ੍ਹਾਂ ਦੀ ਬੁੱਕਸ ਹੈ ਤੁਹਾਡਾ ਵੈਸੇ ਕਿਸ ਟੋਪਿਕ 'ਤੇ ਜ਼ਿਆਦਾ ਇੰਨਟਰਸਟ ਹੈ ਥੋਹਾ ਤੁਹਾਨੂੰ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਜ਼ਿਆਦਾ ਹਾਂਜੀ ਪੰਜਾਬੀ ਸਾਹਿਤ ਨਾਲ ਪੰਜਾਬੀ ਸਾਹਿਤ ਨਾਲ ਮਿਲਦੀਆਂ ਜੁਲਦੀਆਂ ਬਹੁਤ ਬੁੱਕਸ ਆਪਣੇ ਕੋਲ ਹੋਣਗੀਆਂ ਆ ਸਕਦੇ ਹੋ ਤੁਸੀਂ ਦੇਖਿਓ ਆ ਕੇ ਓਕੇ ਠੀਕ ਹੈ ਜੀ ਧੰਨਵਾਦ ਜੀ